ਪਹਿਲੀ ਗੱਲ ਤਾਂ ਇਹ ਜ਼ਮੀਨ ਹੈ ਜਿਹੜੀ ਖਰੀਦਣ ਵੇਚਣ ਦੀ ਗੱਲ ਕਰੀ ਹੈ ਜ਼ਮੀਨ ਮਿਲਦੀ ਹੀ ਬਹੁਤ ਘੱਟ ਹੈ ਨੰਬਰ ਦੋ 'ਤੇ ਅੱਜ ਕੱਲ੍ਹ ਮੰਗਿਆਈ ਬਹੁਤ ਹੋ ਗਈ ਪੈਸੇ ਚਾਹੀਦੇ ਹੈ ਜ਼ਮੀਨ ਖਰੀਦਣ ਲਈ ਉਸ ਤੋਂ ਬਾਅਦ ਫਿਰ ਸਭ ਤੋਂ ਪਹਿਲਾਂ ਪਟਵਾਰੀ ਤੋਂ ਸ਼ੁਰੂ ਹੋ ਜਾਂਦੇ ਆਪਾਂ ਪਟਵਾਰੀ ਤੋਂ ਫਰਦ ਲਓ ਫਰਦ ਲੈਣ ਤੋਂ ਬਾਅਦ ਆਪਾਂ ਰ ਰਜਿਸਟਰੀ ਕਰਾਉਂਦੇ ਹਾਂ ਰਜਿਸਟਰੀ ਕਰਾਉ ਫਿਰ ਤਹਿਸੀਲਦਾਰ ਸਾਹਿਬ ਦੀ ਵੇਟ ਕਰਨੀ ਪੈਂਦੀ ਹੈ ਉਹ ਆਉਣਾ ਆਵੇ ਨਹੀਂ ਕ ਕਈ ਵਾਰੀ ਇਹ ਵੀ ਕਹਿੰਦੇ ਜੀ ਅੱਜ ਤਹਿਸੀਲਦਾਰ ਸਾਹਿਬ ਆਉਣਗੇ ਨਹੀਂ ਫਿਰ ਦੂਜੇ ਦਿਨ ਫਿਰ ਜਾਉ ਫਿਰ ਨਾਲ਼ ਪਿੰਡ ਦਾ ਲੰਬੜਦਾਰ ਲੈਣਾ ਪੈਂਦਾ ਅਤੇ ਸ਼ਾਮ ਨੂੰ ਫਿਰ ਲੰਬੜਦਾਰ ਵੀ ਮਾੜਾ ਮੋਟਾ ਕੁਛ ਕਹਿੰਦਾ ਵੀ ਜੀ ਅੱਜ ਤੁਹਾਡੇ ਨਾਲ਼ ਇਹ ਸਾਰੀ ਦਿਹਾੜੀ ਫੁੱਟ ਗਈ ਉਸ ਤੋਂ ਬਾਅਦ ਫਿਰ ਦੂਜੇ ਦਿਨ ਹੁੰਦੀ ਹੈ ਚਲੋ ਰਜਿਸਟਰੀ ਹੋ ਜਾਂਦੀ ਰਜਿਸਟਰੀ ਤੋਂ ਬਾਅਦ ਫਿਰ ਇੰਤਕਾਲ ਹੁੰਦਾ ਇੰਤਕਾਲ ਦੇ ਲਈ ਆਪਣਾ ਉਹਦੀ ਫਿਰ ਜ਼ਰੂਰਤ ਪੈਂਦੀ ਹੈ ਤਹਿਸੀਲਦਾਰ ਸਾਹਿਬ ਦੀ ਉਹ ਤਹਿਸੀਲਦਾਰ ਸਾਹਿਬ ਬੈਠਾ ਤਾਂ ਕੰਮ ਤੁਹਾਡਾ ਹੋ ਜੇਗਾ ਨਹੀਂ ਉਹ ਵੀ ਦੋ ਜਾਂ ਤਿੰਨ ਦਿਨ ਲੱਗ ਜਾਂਦੇ ਹੈ ਵੈਸੇ ਇਹਨਾਂ ਕੰਮਾਂ ਦੇ ਵਿੱਚ ਮੁਸ਼ਕਿਲਾਂ ਤਾਂ ਬਹੁਤ ਆਉਂਦੀਆਂ ਐਂ ਫਿਰ ਵੀ ਕੰਮ ਭਾਵੇਂ ਹੋ ਜਾਵੇ ਪਰ ਥੋੜ੍ਹਾ ਬਹੁਤਾ ਜਿਵੇਂ ਚਾਹ ਪਾਣੀ ਕਹਿ ਦਿੰਦੇ ਹਾਂ ਅੱਜ ਕੱਲ੍ਹ ਰਿਸ਼ਵਤ ਕਹਿ ਦਿੰਦੇ ਹਾਂ ਉਹ ਵੀ ਕਰਨਾ ਪੈਂਦਾ ਪਿੰਡਾਂ ਦੇ ਲੋਕਾਂ ਨੂੰ ਖਾਸ ਕਰਕੇ ਇਹ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕੰਮ ਹੋ ਜਾਂਦਾ ਪਰ ਥੋੜ੍ਹਾ ਬਹੁਤਾ ਘੁੰਮਣਾ ਪੈਂਦਾ